ਸਤਿ ਸ਼੍ਰੀ ਅਕਾਲ ਜੀ ਮੈਂ ਸ਼ਿਵ ਮੋਟਰਸ ਵਿੱਚ ਗੱਲ ਕਰ ਰਹੀ ਹਾਂ ਮੈਂ ਸਵੇਰੇ ਤੁਹਾਡੇ ਇੱਧਰ ਤੋਂ ਕੈਬ ਬੁੱਕ ਕੀਤੀ ਸੀਗੀ ਮੈਂ ਪਹਿਲੇ ਵੀ ਤੁਹਾਡੇ ਇੱਧਰ ਤੋਂ ਕੈਬ ਕਰਦੀ ਰਹਿੰਦੀ ਹਾਂ ਮੈਨੂੰ ਲੋੜ ਪੈਂਦੀ ਰਹਿੰਦੀ ਹੈ ਅਤੇ ਅੱਜ ਵੀ ਮੈਂ ਬੁੱਕ ਕੀਤੀ ਸੀਗੀ ਅਤੇ ਮੈਂ ਸਤਾਰ੍ਹਾਂ ਦੇ ਬੱਸ ਸਟੈਂਡ ਤੋਂ ਬੁੱਕ ਕੀਤੀ ਸੀਗੀ ਕਿ ਮੈਂ ਤਿੰਨ ਵਜੇ ਤੋਂ ਇੱਥੇ ਤੋਂ ਨਿਕਲਣਾ ਸੀਗਾ ਪਰ ਜਿਹੜਾ ਤੁਹਾਡਾ ਡਰਾਈਵਰ ਹੈ ਉਹ ਹੁਣ ਤੱਕ ਨਹੀਂ ਆਇਆ ਇਸ ਟਾਈਮ ਸਾਢੇ ਚਾਰ ਵੱਜ ਰਹੇ ਨੇ ਅਤੇ ਮੈਂ ਇੱਕ ਡੇਢ ਘੰਟੇ ਤੋਂ ਉਹਦੀ ਵੇਟ ਕਰ ਰਹੀ ਹਾਂ ਅਤੇ ਮੈਂ ਬਾਰ ਬਾਰ ਉਹਨੂੰ ਫੋਨ ਮਿਲਾ ਰਹੀ ਹਾਂ ਬਟ ਉਹ ਮੇਰਾ ਫੋਨ ਰਿਸੀਵ ਨਹੀਂ ਕਰ ਰਿਹਾ ਅਤੇ ਮੈਂ ਇਸ ਕਰਕੇ ਤੁਹਾਨੂੰ ਕੋਲ ਕੀਤੀ ਹੈਗੀ ਹੈ ਕਿ ਮੈਂ ਬਹੁਤ ਪਰੇਸ਼ਾਨ ਹੋ ਰਹੀ ਹਾਂ ਉਹਦੀ ਵਜ੍ਹਾ ਤੋਂ ਅਤੇ ਉਹਦੀ ਵੇਟ ਕਰ ਕਰਕੇ ਥੱਕ ਚੁੱਕੀ ਹਾਂ ਮੇਰੇ ਘਰਦੇ ਵੀ ਮੇਰੀ ਵੇਟ ਕਰ ਰਹੇ ਨੇ ਮੈਂ ਲੇਟ ਹੋ ਰਹੀ ਹਾਂ ਅਤੇ ਘਰ ਵੀ ਮੇਰੇ ਗੈਸਟ ਨੇ ਆਉਣਾ ਏ ਇਸ ਵਜ੍ਹਾ ਕਰਕੇ ਮੈਨੂੰ ਜਲਦੀ ਜਾਣਾ ਸੀਗਾ ਬਟ ਮੈਂ ਔਲਰੇਡੀ ਪਹਿਲੇ ਹੀ ਲੇਟ ਹੈਗੀ ਹਾਂ ਅਤੇ ਮੈਨੂੰ ਜਾਣ ਵਿੱਚ ਵੀ ਕਾਫੀ ਟਾਈਮ ਲੱਗ ਜਾਣਾ ਏ ਅਤੇ ਹੁਣ ਮੈਂ ਇੱਥੇ ਤੋਂ ਮੈਨੂੰ ਆਟੋ ਜਾਂ ਕੋਈ ਬੱਸ ਵਗੈਰਾ ਦੇਖਣੀ ਪੈਣੀ ਹੈ ਉਹ ਵੀ ਟਾਈਮ ਨਾਲ ਹੀ ਮਿਲਣਗੇ ਇਸ ਕਰਕੇ ਮੈਂ ਹਮੇਸ਼ਾਂ ਤੁਹਾਡੀ ਹੀ ਕੈਬ ਬੁੱਕ ਕਰਵਾਉਂਦੀ ਰਹਿੰਦੀ ਹਾਂ ਤਾਂ ਕਿ ਮੈਂ ਟਾਈਮ ਸਿਰ ਆਪਣੇ ਘਰ ਪਹੁੰਚ ਸਕਾਂ ਅਤੇ ਮੈਂ ਹੁਣ ਚਾਹੁੰਦੀ ਹਾਂ ਕਿ ਤੁਸੀਂ ਆਪਣੀ ਜਿਹੜੀ ਡਰਾਈਵਰ ਹੈਗੇ ਨੇ ਉਹਨਾਂ ਦੇ ਖਿਲਾਫ ਐਕਸ਼ਨ ਲਉ ਕਿਉਂਕਿ ਉਹ ਕਸਟਮਰ ਨੂੰ ਇੱਦਾਂ ਪਰੇਸ਼ਾਨ ਕਰਦੇ ਨੇ ਉਹਨਾਂ ਦਾ ਟਾਈਮ ਵੇਸਟ ਕਰਦੇ ਨੇ ਅਤੇ ਜਿਹੜਾ ਮੈਂ ਤੁਹਾਨੂੰ ਕੈਬ ਬੁਕਿੰਗ ਦੇ ਟਾਈਮ ਪੇਮੈਂਟ ਕੀਤੀ ਸੀਗੀ ਔਨਲਾਈਨ ਉਹ ਮੈਂ ਚਾਹੁੰਦੀ ਹਾਂ ਕਿ ਤੁਸੀਂ ਉਹ ਮੇਰੀ ਰਿਫੰਡ ਕਰ ਦਿਉ